ਪੰਜਾਬ ਸਰਕਾਰ ਵੱਲੋਂ ਸਿੱਖਿਆ ਪ੍ਰਣਾਲੀ ਵਿੱਚ ਬਹੁਤ ਹੀ ਵਾਧਾ ਕੀਤਾ ਜਾ ਰਿਹਾ ਹੈ ਅਤੇ ਪਿੰਡ ਪਿੰਡ ਵਿੱਚ ਸਮਾਰਟ ਕਲਾਸਾਂ ਅਤੇ ਵਧੀਆ ਸਕੂਲ ਖੋਲ੍ਹੇ ਜਾ ਰਹੇ ਹਨ ਜਿਸ ਕਰਕੇ ਪਿੰਡਾਂ ਦੇ ਲੋਕ ਵੀ ਉੱਚ ਸਿੱਖਿਆ ਪ੍ਰਾਪਤ ਕਰ ਸਕਣ ਅਤੇ ਸ਼ਹਿਰਾਂ ਵਿੱਚ ਆਉਣ ਦੀ ਬਜਾਏ ਉਹਨਾਂ ਦੇ ਨਜ਼ਦੀਕ ਹੀ ਘੱਟ ਖਰਚੇ ਵਿੱਚ ਉਹਨਾਂ ਨੂੰ ਸਿੱਖਿਆ ਪ੍ਰਾਪਤ ਹੋ ਸਕੇ ਜੋ ਕਿ ਕਾਫੀ ਹੱਦ ਤੱਕ ਪੂਰਤੀ ਵੀ ਹੋ ਗਈ ਹੈ ਇਸ ਕਰਕੇ ਸਾਡੇ ਜ਼ਿਲ੍ਹੇ ਵਿੱਚ ਕਾਫੀ ਸਕੂਲ ਇਹੋ ਜਿਹੇ ਖੋਲ੍ਹੇ ਗਏ ਹਨ ਜੋ ਕਿ ਮੁਫਤ ਸ ਸਿੱਖਿਆ ਪ੍ਰਦਾਨ ਕਰਦੇ ਹਨ ਅਤੇ ਗਰੀਬ ਬੱਚਿਆਂ ਨੂੰ ਮੁਫਤ ਸਿਖਲਾਈ ਦਿੰਦੇ ਹਨ